ਮੋਹਾਲੀ ਵਿੱਚ ਬਹੁਤ ਸਾਰੇ ਟੂਰ ਗਾਈਡਸ ਹਨ ਅਤੇ ਸਾਰੇ ਹੀ ਆਪਣੀ ਆਪਣੀ ਥਾਂ ਬਹੁਤ ਵਧੀਆ ਹਨ ਅਤੇ ਮੈਂ ਕਿਸੇ ਦਾ ਨਾਂ ਨਹੀਂ ਲੈ ਸਕਦੀ